ਮੈਂ ਖਬਰਾਂ ਪੰਜਾਬੀ 'ਚ ਦੇਖਣਾ ਪਸੰਦ ਕਰਦਾ ਹਾਂ ਅਤੇ ਉਹਦੇ ਵਿੱਚ ਕਾਫੀ ਹੁਣ ਅੱਜ ਦੇ ਟਾਈਮ ਵਿੱਚ ਕਾਫੀ ਨਵੇਂ ਚੈਨਲ ਖੁੱਲ੍ਹ ਚੁੱਕੇ ਨੇ ਜੋ ਪੰਜਾਬੀ ਦੇ ਵਿੱਚ ਸਾਨੂੰ ਖਬਰਾਂ ਦੱਸਦੇ ਨੇ ਜਿਹਦੇ ਵਿੱਚ ਹਰ ਖੇਤਰ ਦੀ ਖਬਰ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਗੁਰਬਾਣੀ ਖੇਡ ਵਪਾਰ ਕਰਾਈਮ ਹਰ ਇੱਕ ਚੀਜ਼ ਬਾਰੇ ਖਬਰਾਂ ਮਿਲ ਜਾਂਦੀਆਂ ਨੇ ਅਤੇ ਕਈ ਜਿਹੜੀ ਟੀ ਵੀ ਦੇ ਵਿੱਚ ਨਿਊਜ਼ ਚੈਨਲ ਚਲਦੇ ਨੇ ਬਹੁਤ ਵਧੀਆ ਨੇ ਜਿਹਨਾਂ ਦੇ ਵਿੱਚ ਸਾਰੀ ਖਬਰਾਂ ਸਾਨੂੰ ਪੰਜਾਬੀ 'ਚ ਮਿਲ ਜਾਂਦੀਆਂ ਨੇ ਅਤੇ ਸਾਨੂੰ ਈਜ਼ੀ ਵੇਅ ਨਾਲ ਉਹ ਮਿਲ ਜਾਂਦੀਆਂ ਨੇ